ਮੈਂ ਪੇਂਟਿੰਗ ਪੇਂਟਿੰਗ ਮੈਂ ਪੇਂਟਿੰਗ ਪੇਂਟਿੰਗ ਦੀ ਕਲਾ ਸਕੂਲ ਦੇ ਵਿੱਚ ਸਿੱਖਦੀ ਹੁੰਦੀ ਸੀ ਜਿਵੇਂ ਕਿ ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ ਸਕੂਲ ਵ ਸਕੂਲ ਵਿੱਚੋਂ ਹੀ ਪਿਆ ਸੀਗਾ ਮੈਨੂੰ ਦਸਵੀਂ ਬਾਰਵੀਂ 'ਚ ਪੇਂਟਿੰਗ ਦਾ ਸ਼ੌਕ ਹੋ ਗਿਆ ਸੀਗਾ ਮੈਂ ਉੱਥੇ ਹਰੇਕ ਦੇ ਵਿੱਚ ਭਾਗ ਲੈਂਦੀ ਹੁੰਦੀ ਸੀਗੀ ਮੈਂ ਕਲਾਸਾਂ ਵੀ ਲਗਾਉਣ ਜਾਂਦੀ ਹੁੰਦੀ ਸੀਗੀ ਪੇਂਟਿੰਗ ਦੀਆਂ ਜਿਸ ਨਾਲ ਹੁਣ ਮੈਂ ਘਰਾਂ ਦੇ ਵਿੱਚ ਆਨਲਾਈਨ ਡਿਜ਼ਾਇਨ ਵੇਖ ਵੇਖ ਕੇ ਪੇਂਟ ਵੀ ਕਰਦੀ ਹੈਗੀ ਅਤੇ ਕਈ ਲੋਕਾਂ ਦੇ ਜੀ ਸੂਟ ਵੀ ਪੇਂਟ ਕਰਦੀ ਹਾਂ ਡਿਜ਼ਾਇਨ ਕਰਦੀ ਹੈਗੀ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਅਤੇ ਜਿਹੜਾ ਸਾਰਾ ਹੁਣ ਮੈਨੂੰ ਮੈਨੂੰ ਇੱਦਾਂ ਹੈ ਕਿ ਮੈਂ ਜਿਹੜਾ ਆਹ ਕੰਮ ਹੈਗਾ ਅੱਗੇ ਹੋਰ ਆਨਲਾਈਨ ਵਧਾਵਾ ਅਤੇ ਜਿਸ ਨਾਲ ਕਿ ਵਧੀਆ ਮੇਰੇ 'ਚ ਜਿਹੜਾ ਗੁਣ ਹੈਗਾ ਪੈਦਾ ਹੋ ਗਿਆ ਪੇਂਟਿੰਗ ਦਾ ਅਤੇ ਵਧੀਆ ਉਵੇਂ ਪੇਂਟਿੰਗ ਵਧੀਆ ਕਰ ਲੈਂਦੀ ਹੈਗੀ ਅਤੇ ਸੂਟ ਵੀ ਵਧੀਆ ਤਰੀਕੇ ਨਾਲ ਪੇਂਟ ਹੋ ਜਾਂਦੇ ਹੈਗੇ ਅਤੇ ਪੇਂਟ ਕਰਵਾਉਣਾ ਵੀ ਚਾਹੁੰਦੇ ਨੇ